ਬਰਤਨ ਧੋਣ ਦੀ ਪ੍ਰਕਿਰਿਆ ਤਾਂ ਇਸ ਤਰ੍ਹਾਂ ਹੈ ਜਿੱਦਾਂ ਕਿ ਨੋਰਮਲ ਬਰਤਨ ਤਾਂ ਨੋ ਸ ਜਲਦੀ ਸਾਫ ਹੋ ਜਾਂਦੇ ਹਨ ਜੇ ਤੇਲ ਵਾਲੇ ਤੇਲ ਵਾਲੇ ਬਰਤਨਾਂ ਨੂੰ ਥੋੜ੍ਹਾ ਟਾਈਮ ਲੱਗਦਾ ਹੈ ਉਸ ਲਈ ਉਸਨੂੰ ਚੰਗੀ ਤਰ੍ਹਾਂ ਗਰਮ ਪਾਣੀ ਕਰਕੇ ਉਸ ਉਬਾਲ ਕੇ ਅਤੇ ਫਿਰ ਨਿਪੁ ਵਿਮ ਬਾਰ ਪਾ ਕੇ ਉਸਨੂੰ ਚੰਗੀ ਤਰ੍ਹਾਂ ਰਗੜ ਕੇ ਰੱਖ ਥੋੜ੍ਹੀ ਦੇਰ ਗਰਮ ਪਾਣੀ ਵਿੱਚ ਡੁੱਬਿਆ ਰਹਿਣ ਦੇਣਾ ਚਾਹੀਦਾ ਤਾਂ ਕਿ ਜੋ ਤੇਲ ਹੈ ਸਾਰਾ ਗਰਮ ਪਾਣੀ ਨਾਲ ਉੱਬਲ ਕੇ ਬ ਨਿਕਲ ਕੇ ਬਾਹਰ ਆ ਜਾਵੇ ਇਸ ਲਈ ਉਸ ਤੋਂ ਇੱਕ ਘੰ ਲ ਇੱਕ ਘੰਟਾ ਰੱਖ ਦਿੱਤਾ ਜਾਂਦਾ ਹੈ ਗਰਮ ਪਾਣੀ ਵਿੱਚ ਨਿਪ ਵਿੰਮ ਬਾਰ ਪਾ ਕੇ ਉਸਨੂੰ ਰੱਖ ਦਿੱਤਾ ਜਾਂਦਾ ਹੈ ਕਿ ਇਸ ਲਈ ਤਾਂ ਕਿ ਜੋ ਸਾਰਾ ਤੇਲ ਹੈ ਚੰਗੀ ਤਰ੍ਹਾਂ ਬਾਹਰ ਆ ਜਾਵੇ ਅਤੇ ਉਸਦੀ 'ਚ ਬਾਅਦ ਵਿੱਚ ਆਰਾਮ ਨਾਲ ਸਫਾਈ ਹੋ ਜਾਵੇ ਅਤੇ ਉਸ ਤੋਂ ਬਾਅਦ ਜਿਹੜੇ ਚੋਲ ਵਾਲੇ ਬਰਤਨ ਹੁੰਦੇ ਹਨ ਉਸ ਨੂੰ ਵੀ ਗਰਮ ਪਾਣੀ ਵਿੱਚ ਰੱਖ ਦਿੱਤਾ ਜਾਂਦਾ ਹੈ ਤਾਂ ਕਿ ਉਹ ਸਾਫ ਹੋ ਜਾਵੇ ਗਰਮ ਪਾਣੀ ਨਾਲ ਸਾਰੀ ਕੁਛ ਨਿਕਲ ਕੇ ਉੱਬਲ ਕੇ ਬਾਹਰ ਆ ਜਾਂਦਾ ਹੈ ਇਸ ਲਈ ਤੇਲ ਵਾਲੇ ਬਰਤਨ ਇਸ ਤਰ੍ਹਾਂ ਸਾਫ ਕੀਤੇ ਜਾਂਦੇ ਹਨ ਇਸ ਲਈ ਇਸ ਬਰਤਨ ਨੂੰ ਥੋੜ੍ਹਾ ਟਾਈਮ ਲੱਗਦਾ ਹੈ ਸਾਫ ਕਰਨ ਵਿੱਚ ਤਾਂ ਕਰਕੇ ਗਰਮ ਪਾਣੀ ਚੰਗੀ ਤਰ੍ਹਾਂ ਪਾ ਦਿੱਤਾ ਜਾਂਦਾ ਹੈ ਕਿ ਇਸ ਦੀ ਸਾਰੀ ਜੋ ਹੰਗਾਲ ਹੈ ਤੇਲ ਦਾ ਸਾਰਾ ਕੁਝ ਉੱਬਲ ਕੇ ਬਾਹਰ ਆ ਜਾਵੇ ਅਤੇ ਇਸ ਨੂੰ ਸਾਫ ਕਰਨ ਵਿੱਚ ਥੋੜ੍ਹੀ ਮਿਹਨਤ ਜ਼ਰੂਰ ਲੱਗਦੀ ਹੈ ਪਰ ਤੇਲ ਸਾਰਾ ਚੰਗੀ ਤਰ੍ਹਾਂ ਬਾਹਰ ਆ ਜਾਂਦਾ ਹੈ